ਰਿਟਾਈਡ ਅਤੇ ਬਜ਼ੁਰਗਾਂ ਲਈ ਟੈਕਨੋਲੋਜੀ ਬਹੁਤ ਲਾਭਦਾਇਕ ਹੈ ਕਿਉਂਕਿ ਬਜ਼ੁਰਗ ਨਾ ਤਾਂ ਕਿਤੇ ਜਾ ਸਕਦੇ ਹਨ ਉਹ ਘਰ ਹੀ ਬੈਠੇ ਰਹਿੰਦੇ ਹਨ ਇਸ ਲਈ ਉਹ ਟੀ ਵੀ ਦੀ ਵਰਤੋਂ ਜ਼ਿਆਦਾਤਰ ਕਰਦੇ ਹਨ ਉਹ ਟੀ ਵੀ 'ਤੇ ਨਿਊਜ਼ ਭਜਨ ਜਾਂ ਮੂਵੀ ਦੇਖ ਲੈਂਦੇ ਹਨ ਅ ਜਾਂ ਜ਼ਿਆਦਾਤਰ ਖਬਰਾਂ ਦੇਖ ਕੇ ਸਮਾਂ ਬਿਤਾ ਲੈਂਦੇ ਹਨ ਐਜੂਕੇ ਐਜੂਕੇਸ਼ਨ ਵਾਲੇ ਬਜ਼ੁਰਗ ਟੀ ਮੋਬਾਈਲ ਚਲਾ ਲੈਂਦੇ ਹਨ ਅਤੇ ਆਪਣਾ ਸਮਾਂ ਬਿਤਾ ਲੈਂਦੇ ਹਨ ਇਸ ਨਾਲ ਉਹਨਾਂ ਦਾ ਮਨੋਰੰਜਨ ਹੋ ਜਾਂਦਾ ਹੈ ਅਤੇ ਉਹ ਨੂੰ ਉਹਨਾਂ ਨੂੰ ਸਾ ਪਤਾ ਲੱਗਦਾ ਰਹਿੰਦਾ ਹੈ ਬਾਹਰਲੀ ਦੁਨੀਆਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਅਤੇ ਉਹ ਨਵੀਂ ਅਪਡੇਟ ਆਪਣੇ ਘਰਦਿਆਂ ਵਿੱਚ ਵੀ ਸਾਂਝੀ ਕਰ ਲੈਂਦੇ ਹਨ ਜਿਸ ਨਾਲ ਕਈ ਸਾਰੇ ਵੈੱਲ ਐਜੂਕੇਟਿਡ ਰਹਿੰਦੇ ਹਨ